ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਤੁਸੀਂ ਰੈਜੀਡੈਂਟ ਹੋ ਪੰਜਾਬ ਦੇ ਮੈਂ ਪੁੱਛਣਾ ਸੀਗਾ ਵੀ ਅਸੀਂ ਇੱਥੇ ਘੁੰਮਣ ਆਏ ਸੀਗੇ ਪੰਜਾਬ ਆਉਣਾ ਸੀਗਾ ਅਤੇ ਤੁਸੀਂ ਮੈਨੂੰ ਦੱਸ ਸਕਦੇ ਓਂ ਵੀ ਇਸ ਟਾਈਮ ਪੰਜਾਬ ਦਾ ਮੌਸਮ ਕਿਵੇਂ ਦਾ ਆ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਪੁੱਛਣਾ ਸੀਗਾ ਵੀ ਮੌਸਮ ਕਿਵੇਂ ਦਾ ਹੋਵੇਗਾ ਜਿਵੇਂ ਤੁਸੀਂ ਹੁਣ ਦੱਸਿਆ ਹੈਗਾ ਵੀ ਹੁਣ ਅੱਗੇ ਠੰਡ ਆ ਰਹੀ ਆ ਸ਼ਹੀਦੀ ਜੋੜ ਮੇਲਾ ਵੀ ਲੱਗਦਾ ਆ ਪਰ ਮੈਂ ਨਾ ਪੂਰੀ ਫੈਮਿਲੀ ਦੇ ਨਾਲ ਆਉਣਾ ਸੀਗਾ ਇਸ ਲਈ ਤੁਹਾਡੇ ਤੋਂ ਸਲਾਹ ਲੈਣੀ ਸੀ ਵੀ ਅਸੀਂ ਕਿਸ ਟਾਈਮ ਆ ਸਕਦੇ ਹਾਂ ਅਤੇ ਅਸੀਂ ਇੱਥੇ ਦਾ ਮੌਸਮ ਕਿਵੇਂ ਦਾ ਹੋਵੇਗਾ ਤਾਂ ਜੋ ਅਸੀਂ ਮੈਂ ਆਪਣੀ ਪੂਰੀ ਫੈਮਿਲੀ ਨੂੰ ਲੈ ਕੇ ਇੱਥੇ ਆ ਸਕਾਂ ਘੁੰਮਣ ਵਾਸਤੇ ਹਾਂਜੀ ਅਗਰ ਅਸੀਂ ਦਸੰਬਰ ਤੱਕ ਨਾ ਸਕੇ ਤਾਂ ਅੱਗੇ ਕਦੋਂ ਤੱਕ ਆ ਸਕਦੇ ਹਾਂ ਹਾਂਜੀ ਠੀਕ ਹੈ ਜੀ ਠੀਕ ਹੈ ਮੈਂ ਤੁਹਾਨੂੰ ਬਾਅਦ 'ਚ ਕੋਲ ਕਰਕੇ ਦੱਸ ਦਾਵਾਂਗੀ ਵੀ ਸਾਡਾ ਕਦੋਂ ਦਾ ਪਲਾਨ ਬਣਦਾ ਹੈਗਾ ਅਤੇ ਨਾਲ ਮੈਂ ਤੁਹਾਨੂੰ ਕੋਲ ਕਰਦੂਂਗੀ ਓਕੇ ਜੀ